ਮੇਰੇ ਦੋਸਤ ਨੇ ਇੱਕ ਕਿਤਾਬ ਦੀ ਦੱਸ ਪਾਈ ਸੀ ਜਿਸ ਦਾ ਨਾਮ ਸੀ ਰਾਣੀ ਤੱਤ ਅਤੇ ਇਸ ਦਾ ਲੇਖਕ ਸੀ ਹਰਮਨਜੀਤ ਭਾਵੇਂ ਕਿ ਇਸ ਕਿਤਾਬ ਨੂੰ ਯੁਵਾ ਐਕਡਮੀ ਸਾਹਿਤ ਐਕਡਮੀ ਅਵਾਰਡ ਵੀ ਮਿਲ ਚੁੱਕਾ ਹੈ ਪ੍ਰੰਤੂ ਫੇਰ ਵੀ ਮੇਰੇ ਦੇਖਣ ਵਿੱਚ ਇਹ ਆਇਆ ਹੈ ਕਿ ਇਸ ਕਿਤਾਬ ਦੀ ਵਿਕਰੀ ਬਹੁਤ ਜ਼ਿਆਦਾ ਹੋ ਗਈ ਹੈ ਉਸ ਦਾ ਕਾਰਨ ਇਹ ਸੀ ਕਿ ਇਸਦੀ ਮਸ਼ਹੂਰੀ ਬਹੁਤ ਜ਼ਿਆਦਾ ਹੋ ਗਈ ਮਸ਼ਹੂਰੀ ਦੇ ਚਲਦਿਆਂ ਚਲਦਿਆਂ ਇਹ ਕਿਤਾਬ ਇੰਨੀ ਪ੍ਰਚਲਿਤ ਹੋ ਗਈ ਕਿ ਜਿੱਥੇ ਵੀ ਕਿਤੇ ਦੇਖਦੇ ਸਾਂ ਇਸ ਕਿਤਾਬ ਦਾ ਹੀ ਚਰਚਾ ਹੁੰਦਾ ਸੀ ਇਹ ਗੱਲ ਜਦੋਂ ਮੇਰੇ ਦਿਮਾਗ ਵਿੱਚ ਆਈ ਤਾਂ ਮੈਂ ਇਹ ਆਪਣੇ ਦੋਸਤ ਦੇ ਕਹਿਣ 'ਤੇ ਕਿਤਾਬ ਮੰਗਵਾ ਲਈ ਪ੍ਰੰਤੂ ਜਦੋਂ ਪੜ੍ਹ ਕੇ ਦੇਖੀ ਤਾਂ ਮੇਰੇ ਹੱਥ ਨਿਰਾਸ਼ਾ ਹੀ ਲੱਗੀ ਇਹ ਕਿਤਾਬ ਕਵਿਤਾਵਾਂ ਦਾ ਸੰਗ੍ਰਹਿ ਹੈ ਅਤੇ ਨਾਲ ਦੀ ਨਾਲ ਹੀ ਵਾਰਤਕ ਵੀ ਇਸ ਵਿੱਚ ਦੇਖਿਆ ਜਾ ਜਾ ਸਕਦਾ ਹੈ ਕਵਿਤਾਵਾਂ ਦੀ ਗੱਲ ਕਰੀਏ ਤਾਂ ਕਵਿਤਾਵਾਂ ਦੀ ਦਿੱਖ ਤਾਂ ਸੋਹਣੀ ਹੈ ਅਤੇ ਸ਼ਬਦਾਂ ਦਾ ਪ੍ਰਯੋਗ ਵੀ ਸੋਹਣਾ ਕੀਤਾ ਗਿਆ ਹੈ ਪ੍ਰੰਤੂ ਜਦੋਂ ਅਸੀਂ ਉਹਦੇ ਸ਼ਬਦ ਜੋੜ ਜਾਂ ਸਤਰਾਂ ਨੂੰ ਮੇਲ ਮਿਲਾਪ ਕਰਕੇ ਦੇਖਦੇ ਹਾਂ ਤਾਂ ਕੋਈ ਢੁੱਕਵਾਂ ਅਰਥ ਨਹੀਂ ਨਿਕਲਦਾ ਜਾਪਦਾ ਲੇਖਕ ਨੇ ਸਿਰਫ਼ ਅਲੋਕਾਰੀ ਸ਼ਬਦ ਹੀ ਵਰਤੇ ਹਨ ਜਿਹੜੇ ਕਿ ਪੜ੍ਹਨ ਵਾਲੇ ਨੂੰ ਸ਼ਬਦ ਦਰ ਸ਼ਬਦ ਚੰਗੇ ਤਾਂ ਲੱਗ ਸਕਦੇ ਹਨ ਪ੍ਰੰਤੂ ਉਹ ਜਿਸ ਲਹਿ ਦੇ ਵਿੱਚ ਜਾਂ ਜਿਸ ਲੜੀ ਦੇ ਵਿੱਚ ਪਰੋਏ ਗਏ ਹਨ ਉਹ ਅਰਥਾਂ ਨੂੰ ਸਪਸ਼ਟ ਨਹੀਂ ਕਰਦੇ ਉਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਲੇਖਕ ਨੇ ਇਹ ਸੋਚਿਆ ਹੋਵੇ ਕਿ ਨੌਜਵਾਨ ਪੀੜ੍ਹੀ ਨੂੰ ਉਰਦੂ ਦੇ ਸ਼ਬਦ ਜਾਂ ਕੁਛ ਏਦਾਂ ਦਾ ਦਿਲ ਖਿੱਚਵੇਂ ਸ਼ਬਦ ਵਰਤ ਲਏ ਜਾਣ ਕਿ ਪੜ੍ਹਨ ਵਾਲੇ ਦਾ ਧਿਆਨ ਸਿਰਫ਼ ਸਤਰਾਂ ਦੇ ਉੱਪਰ ਹੀ ਜਾਵੇ ਅਰਥ ਬਣਦਾ ਹੈ ਜਾਂ ਨਹੀਂ ਬਣਦਾ ਹੈ ਉਹ ਨਾ ਦੇਖਿਆ ਜਾਵੇ ਇਸ ਗੱਲ ਨਾਲ ਮੈਨੂੰ ਬੜੀ ਨਿਰਾਸ਼ਾ ਹੋਈ ਅਤੇ ਸਭ ਤੋਂ ਬੜੀ ਨਿਰਾਸ਼ਾ ਤਾਂ ਇਹ ਹੀ ਹੋਈ ਕਿ ਇਸ ਨੂੰ ਸਾਹਿਤ ਅਕੈਡਮੀ ਐਵਾਰਡ ਮਿਲ ਗਿਆ ਜੇ ਇਸ ਦੇ ਵਾਰਤਕ ਭਾਗ ਦੀ ਗੱਲ ਕੀਤੀ ਜਾਵੇ ਤਾਂ ਵਾਰਤਕ ਭਾਗ ਵਿਚ ਵੀ ਕੁਛ ਐਵੇਂ ਦਾ ਹੀ ਹੈ ਜੋ ਗੱਲਾਂ ਅਸੀਂ ਅਸਾਨ ਤਰੀਕੇ ਨਾਲ ਕਹਿ ਸਕਦੇ ਹਾਂ ਉਸਨੂੰ ਬੇਲੋੜੇ ਸ਼ਬਦਾਂ ਵਿੱਚ ਪਰੋ ਪਰੋ ਕੇ ਅਰਥਾਂ ਦਾ ਅਨਰਥ ਹੀ ਕੀਤਾ ਗਿਆ ਹੈ ਅਰਥ ਤਾਂ ਕੀ ਕਰਨੇ ਹਨ ਪ੍ਰੰਤੂ ਇੱਕ ਸਤਰ ਦੇ ਲੰਬਾ ਕਰ ਕਰਕੇ ਇੰਨਾ ਲੰਬਾ ਕਰ ਦਿੱਤਾ ਗਿਆ ਹੈ ਕਿ ਸ਼ਬਦਾਂ ਦਾ ਰੂਪ ਹੀ ਬਦਲ ਦਿੱਤਾ ਗਿਆ ਹੈ ਅਤੇ ਜੋ ਗੱਲ ਉਹ ਕਹਿਣੀ ਚਾਹੁੰਦਾ ਸੀ ਉਹ ਕਹਿਣ ਦੀ ਬਜਾਏ ਉਸ ਨੇ ਹੋਰ ਹੀ ਗੱਲ ਕਰ ਦਿੱਤੀ ਹੈ ਜੋ ਕਿ ਪਾਠਕ ਨੂੰ ਸਮਝ ਵੀ ਨਹੀਂ ਆਉਂਦੀ ਇਸ ਲਈ ਮੈਂ ਇਸ ਕਿਤਾਬ ਤੋਂ ਬਹੁਤ ਨਿਰਾਸ਼ ਹੋਇਆ ਸੀ